ਹੈਲੋ ਹਾਂਜੀ ਆਂਟੀ ਸਤਿ ਸ਼੍ਰੀ ਅਕਾਲ ਹੋਰ ਸੁਣਾ ਠੀਕ ਹੈ ਜੀ ਤੁਸੀਂ ਦੱਸੋ ਕਿਵੇਂ ਠੀਕ ਆ ਕੁਛ ਨਹੀਂ ਮੈਂ ਸਬਜ਼ੀ ਬਣਾਈ ਜਾਂਦੀ ਸੀਗੀ ਤੁਸੀਂ ਕੀ ਕਰਦੇ ਸੀ ਹਾਂਜੀ ਠੀਕ ਆ ਵਧੀਆ ਸਾਰੇ ਹੋਰ ਤੁਸੀਂ ਕਰਦੇ ਸੀ ਹਾਂਜੀ ਹਾਂਜੀ ਸਹੀ ਹੋ ਅਤੇ ਬੱਚੇ ਠੀਕ ਆ ਠੀਕ ਠੀਕ ਜੀ ਹੋਰ ਠੀਕ ਆ ਜਾ ਆਈ ਵਿਆਹ ਹੋਰ ਹਾਂਜੀ ਆਂਟੀ ਕੋਈ ਨਹੀਂ ਹਾਂ ਸਹੀ ਗੱਲ ਹਾਂਜੀ ਆਹ ਵੇਖੋ ਜਿਹੜੇ ਸੜਕਾਂ ਸੁੜਕਾਂ ਵਾਲੇ ਆ ਕੋਈ ਨਹੀਂ ਰਹਿੰਦਾ ਗਾ ਇਹਨਾਂ ਨੂੰ ਚਾਹੀਦਾ ਹਾਂ ਹਾਂਜੀ ਇਹ ਤਾਂ ਬੜਾ ਮੁਸ਼ਕਿਲ ਹੋਇਆ ਪਿਆ

ਉਹ ਤਾਂ ਹਾਂਜੀ ਇਹਨਾਂ ਨੂੰ ਐਂ ਚਾਹੀਦਾ ਨਾਲ ਦੀ ਨਾਲ ਭਰਨੇ ਚਾਹੀਦੇ ਆ ਹਾਂਜੀ ਨਾਲੇ ਨਾਲ ਦੀ ਨਾਲ ਐਂ ਆ ਵੀ ਕੰਮ ਕੰਪਲੀਟ ਕਰਨਾ ਚਾਹੀਦਾ ਪਰ ਹਾਂਜੀ ਹਾਂਜੀ ਹਾਂਜੀ ਹਾਂ ਨਹੀਂ ਆਪਾਂ ਨੂੰ ਕਰਨਾ ਪੈਣਾ ਆਂਟੀ ਚੱਲੋ ਵੇਂਦੀ ਆ ਵਿੱਚ ਕੋਈ ਮਿਸਤਰੀ ਮੁਸਤਰੀ ਕੁਝ ਪਵਾ ਦੇਵੇ ਹੈ ਨਾ ਅਤੇ ਕੋਈ ਨਹੀਂ ਜੀ ਘਰ ਹੀ ਹਾਂ ਉਹ ਹੀ ਲਵਾਉਣਾ ਪੈਣਾ ਹਾਂਜੀ ਸੀਮੈਂਟ ਵਗੈਰਾ ਕੁਛ ਉੱਪਰ ਪਵਾ ਕੇ ਨਾ ਉਹ ਅਤੇ ਫਿਰ ਮਿਸਤਰੀ ਤੋ ਕਰਵਾ ਲਵਾਂਗੇ ਉਹ ਬੰਦ ਕਰ ਜਾਵੇਗਾ ਹਨਾ ਹੋਰ ਤਾਂ ਫਿਰ ਕੀ ਕੀਤਾ ਜਾ ਸਕਦਾ ਹੋਰ ਆਂਟੀ ਬੜੀ ਪ੍ਰੋਬਲਮ ਆਉਂਦੀ ਕਿਤੇ ਨਾ ਜਾ ਹਾਂਜੀ ਉਹ ਕੀਤੇ ਜਾ ਕੇ ਆਈ ਦਾ ਗੱਡੀ ਗੁੱਡੀ ਕ ਲੰਘਦੀ ਹੈ ਨਾ ਠਾਹ ਦੇਣੇ ਵਿੱਚ ਟੈਰ ਵੱਜਦਾ ਹਾਂ ਬਹੁਤ ਪ੍ਰੋਬਲਮ ਆਉਂਦੀ ਹੈ ਤਾਹੀਓਂ ਤਾਂ ਕਹੀ ਦਾ ਇਹ ਤਾਂ ਹੱਲ ਕਰਨਾ ਹੀ ਪੈਣਾ ਅਤੇ ਮਿਸਤਰੀ ਨੂੰ ਅੰਕਲ ਨੂੰ ਕਹਿ ਦਿਓ ਫਿਰ ਹੈ ਨਾ ਹਾਂਜੀ ਹਾਂਜੀ ਨਹੀਂ ਨਿਕਲਦੀ ਆਂਟੀ ਮੈਂ ਤੁਹਾਨੂੰ ਦੱਸੀ ਜਾਂਦੀ ਹਾਂ ਵੀ ਠਾਹ ਦੇਣੀ ਵੱਜਦੀ ਆ ਖੜਕਾ ਵੀ ਬਹੁਤ ਹੁੰਦਾ ਨਾ ਹਾਂ ਹਾਂਜੀ ਹਾਂਜੀ ਨਹੀਂ ਤੁਸੀਂ ਕਹੋ ਹਾਂਜੀ ਨਹੀਂ ਆਂਟੀ ਜਮਾ ਨਹੀਂ ਧਿਆਨ ਦਿੰਦੇ ਹੈਗੇ ਹਾਂਜੀ ਨਹੀਂ ਅੰਕਲ ਨੂੰ ਕਹੋ ਨਾ ਕਿਸੇ ਮਿਸਤਰੀ ਨੂੰ ਬੁਲਾ ਕੇ ਨਾ ਅਤੇ ਕਰਵਾ ਲਈਏ ਆਪਾਂ ਇੱਕ ਵਾਰੀ ਹਨਾ ਹਾਂ ਚੱਲੋ ਠੀਕ ਆ ਹਾਂਜੀ ਹਾਂਜੀ ਓਕੇ ਆਂਟੀ ਜੀ